ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ ਭੰਗੜਾ ਪਾਉਣ ਦੇ ਨਾਲ ਜਿੱਥੇ ਜਿੱਥੇ ਕਿ ਸਾਡਾ ਮਾਨਸਿਕ ਸੰਤੁਲਨ ਠੀਕ ਹੁੰਦਾ ਹੈ ਖੁਸ਼ੀ ਵਾਲਾ ਹੁੰਦਾ ਹੈ ਉਹਦੇ ਨਾਲ ਨਾਲ ਸਾਡਾ ਸਰੀਰਕ ਤੌਰ 'ਤੇ ਵੀ ਅਸੀਂ ਫਿੱਟ ਰਹਿੰਦੇ ਹਾਂ ਸੋ ਭੰਗੜਾ ਪਾਉਣਾ ਇੱਕ ਤਾਂ ਸਾਨੂੰ ਸਾਡੀ ਪੰਜਾਬੀ ਅਤੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਅਤੇ ਪੰਜਾਬੀ ਕਲਚਰ ਦੇ ਨਾਲ ਜੋੜਦਾ ਹੈ ਭੰਗੜਾ ਬਹੁਤ ਹੀ ਪੁਰਾਤਨ ਸਮੇਂ ਤੋਂ ਉਹ ਵਾਲਾ ਚੀਜ਼ ਮੰਨੀ ਜਾਂਦੀ ਹੈ ਪੰਜਾਬੀਆਂ ਦੇ ਵਿੱਚ ਜੋ ਕਿ ਜਿਹਦੇ ਜਿਹੜਾ ਕਿ ਸਾਡੀ ਪੰਜਾਬੀਅਤ ਨੂੰ ਦਰਸਾਉਂਦਾ ਹੈ ਭੰਗੜਾ ਪਾਉਂਦੇ ਹੋਏ ਬੋਲੀਆਂ ਔਰ ਜੋ ਗਾਣੇ ਲੱਗੇ ਹੁੰਦੇ ਨੇ ਉਹ ਗਾਣਿਆਂ ਦੇ ਥਰੂ ਵੀ ਇੱਕ ਬਹੁਤ ਹੀ ਅੱਛਾ ਮੈਸਜ ਜਾਂਦਾ ਹੈ ਕਿ ਅਸੀਂ ਲੋਕ ਕਿਸ ਤਰੀਕੇ ਦਾ ਜੀਵਨ ਜੀ ਰਹੇ ਹਾਂ ਪੰਜਾਬ ਵਿੱਚ ਕਿਸ ਤਰੀਕੇ ਦੀ ਖੁਸ਼ੀ ਮਨਾਉਂਦੇ ਹਾਂ ਕਿਸੇ ਵੀ ਖੁਸ਼ੀ ਦੇ ਵੇਲੇ ਚਾਹੇ ਉਹ ਵਿਆਹ ਸ਼ਾਦੀ ਹੋਵੇ ਚਾਹੇ ਕਿਸੇ ਦਾ ਜੰਮਣਾ ਹੋਵੇ ਚਾਹੇ ਕਿਸੇ ਦੇ ਘਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਆਈ ਹੋਵੇ ਅਤੇ ਭੰਗੜਾ ਇੱਕ ਸਾਡਾ ਖੁਸ਼ੀ ਮਨਾਉਣ ਦਾ ਤਰੀਕਾ ਸਮਝਿਆ ਜਾਂਦਾ ਹੈ ਉਹਦੇ ਕੁ ਨਾਲ ਨਾਲ ਮੈਂ ਇਹ ਸਮਝਦੀ ਹਾਂ ਕਿ ਭੰਗੜੇ ਦੇ ਵਿੱਚ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੱਥ ਹੈ ਆਪਣਾ ਤਿਉਹਾਰਾਂ ਦਾ ਸ ਸੋ ਇਹ ਤਿਉਹਾਰਾਂ ਦੇ ਵਿੱਚ ਬਹੁਤ ਹੀ ਇੱਕ ਮਹੱਤਵਪੂਰਨ ਹਿੱਸਾ ਬਣਦਾ ਹੈ ਸੋ ਸਾਨੂੰ ਅ ਜਿਵੇਂ ਕਿ ਵਿਸਾਖੀ ਹੋ ਗਿਆ ਔਰ ਹੋਰ ਵੀ ਪੰਜਾਬ ਦੇ ਪੰਜਾਬ ਇੱਕ ਰੰਗ ਬਿਰੰਗਾ ਆਪਾਂ ਮੰਨਦੇ ਹਾਂ ਸਟੇਟ ਜਿਹਦੇ ਵਿੱਚ ਹਰ ਤਰ੍ਹਾਂ ਦਾ ਆਪਾਂ ਆਪਣਾ ਖੁਸ਼ੀ ਪ੍ਰਗਟ ਕਰਨ ਦਾ ਤਰੀਕਾ ਲੱਭਦੇ ਹਾਂ ਸੋ ਮੈਂ ਸਮਝਦੀ ਹਾਂ ਕਿ ਸਾਨੂੰ ਇਹਨਾਂ ਨੂੰ ਬਹੁ ਜ਼ਰੂਰ ਆਪਾਂ ਇੱਕ ਮਹੱਤਵਪੂਰਨ ਜਗ੍ਹਾ ਦੇਣੀ ਚਾਹੀਦੀ ਹੈ ਅਤੇ ਆਪਣਾ ਕੋਂਟਰੀਬਿਊਸ਼ਨ ਆਪਣੀ ਸਟੇਟ ਨੂੰ ਦੇਣਾ ਚਾਹੀਦਾ ਹੈ ਸੋ ਇਹਦੇ ਦੌਰਾਨ